ਭਾਰਤ ਵਿੱਚ ਅੱਜ ਕੱਲ੍ਹ ਰਾਜਨੀਤਿਕ ਬਹੁਤ ਪਾਰਟੀਆਂ ਹਨ ਜਿਵੇਂ ਕਿ ਬੀ ਜੇ ਪੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਆਦਿ ਬਹੁਤ ਪਾਰਟੀਆਂ ਨੇ ਅੱਜ ਕੱਲ੍ਹ ਇਹਨਾਂ ਪਾਰਟੀਆਂ ਦਾ ਅੱਜ ਕੱਲ੍ਹ ਬਹੁਤ ਮਾੜਾ ਹਾਲ ਚੱਲ ਰਿਹਾ ਸਭ ਤੋਂ ਮਾੜਾ ਹਾਲ ਕਾਂਗਰਸ ਦਾ ਚੱਲ ਰਿਹਾ ਜੋ ਕਿ ਕਿਸੇ ਸਮੇਂ ਬਹੁਤ ਤਰੱਕੀਆਂ 'ਤੇ ਸੀਗੀ ਅਤੇ ਹਰ ਪਾਸੇ ਕਾਂਗਰਸ ਦੀ ਸਰਕਾਰ ਬਣਦੀ ਸੀ ਅਤੇ ਪੀ ਐੱਮ ਵੀ ਕਾਂਗਰਸ ਦਾ ਹੀ ਰਹਿੰਦਾ ਸੀ ਅਤੇ ਅੱਜ ਕੱਲ੍ਹ ਇਹ ਸਾਰਾ ਕੁਛ ਬੀ ਜੇ ਪੀ ਦੇ ਅੰਡਰ ਚਲੇ ਗਿਆ ਬੀ ਜੇ ਪੀ ਜਿੱਥੇ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੋ ਵਾਰੀ ਪੀ ਐੱਮ ਬਣ ਚੁੱਕਾ ਹੈ ਅਤੇ ਅੱਜ ਕੱਲ੍ਹ ਅਮਿਤ ਸ਼ਾਹ ਅਤੇ ਹੋਰ ਬਹੁਤ ਲੀਡਰ ਨੇ ਜੋ ਅੱਜ ਕੱਲ੍ਹ ਮਤਲਬ ਕਿ ਬੀ ਜੇ ਪੀ ਨੂੰ ਉੱਪਰ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਆਪਾਂ ਗੱਲ ਕਰੀਏ ਨਾ ਪਸੰਦ ਦੀ ਨਾ ਪਸੰਦ ਤਾਂ ਮਤ ਕਹਿ ਸਕਦੇ ਹਾਂ ਆਪਾਂ ਜਿੱਦਾਂ ਜਿਵੇਂ ਕਿ ਅ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਨੋਟਬੰਦੀ ਅਤੇ ਹੋਰ ਬਹੁਤ ਟੋਪਿਕ ਨੇ ਜਿਵੇਂ ਕਿ ਨਸ਼ਿਆਂ ਦਾ ਆਪਾਂ ਨਸ਼ਿਆਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਨਸ਼ੇ ਅੱਜ ਕੱਲ੍ਹ ਬਹੁਤ ਚੱਲ ਰਹੇ ਨੇ ਪੰਜਾਬ ਵਿੱਚ ਨਸ਼ੇ ਬਹੁਤ ਕਰ ਲੇ ਮੇਰਾ ਮਨਪਸੰਦ ਨੇਤਾ ਆਪਾਂ ਭਗਵੰਤ ਮਾਨ ਦੀ ਗੱਲ ਕਰੀਏ ਜਿਵੇਂ ਉਹ ਅੱਜ ਕੱਲ੍ਹ ਉਹਨਾਂ ਨੂੰ ਮੈਂ ਕੁਐਸ਼ਨ ਪੁੱਛਾਂ ਤਾਂ ਉਹਨਾਂ ਨੂੰ ਮੈਂ ਪੁੱਛਾਂਗਾ ਪੰਜਾਬ ਲਈ ਤੁਸੀ ਕੀ ਕੀਤਾ ਹੈ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਪੰਜਾਬ ਵਿੱਚ ਨਸ਼ਾ ਮੁਕਤ ਕਰ ਦੋਗੇ ਅਤੇ ਨੌਕਰੀਆਂ ਦਾ ਕਹਿੰਦੇ ਸੀਗੇ ਅੱਜ ਤ ਮਤਲਬ ਹਰ ਸਾਲ ਤੀਹ ਹਜ਼ਾਰ ਜਾਂ ਚਾਲੀ ਹਜ਼ਾਰ ਨੌਕਰੀਆਂ ਕੱਢੋਗੇ ਕਿ ਅੱਜ ਕੱਲ੍ਹ ਉਹ ਕੁਝ ਨਹੀਂ ਹੋ ਰਿਹਾ ਅਤੇ ਉਹਨਾਂ ਦੇ ਉਹ ਸਾਰੇ ਵਾਅਦੇ ਵਾਅਦੇ ਹੀ ਰਹਿ ਗਏ ਨੇ